ਭੰਗੜਾ ਪੰਜਾਬ ਦਾ ਸਭ ਤੋਂ ਪ੍ਰਮੁੱਖ ਲੋਕ ਨਾਚ ਹੈ ਇਹ ਕਿਸੇ ਵੀ ਵਿਆਹ ਸ਼ਾਦੀ 'ਤੇ ਜਾਂ ਕਿਸੇ ਵੀ ਪ੍ਰੋਗਰਾਮ 'ਤੇ ਪੰਜਾਬੀ ਭੰਗੜੇ ਦੇ ਪਾਉਂਦੇ ਹਨ ਇਸ ਨੂੰ ਅਲੱਗ ਅਲੱਗ ਤਰੀਕੇ ਨਾਲ ਵੀ ਪ੍ਰੈਜੈਂਟ ਕ ਕੀਤਾ ਜਾ ਪਰੀਪ੍ਰੈਜੈਂਟ ਕੀਤਾ ਜਾਂਦਾ ਹੈ ਜਿਵੇਂ ਸਕੂਲਾਂ ਕਾਲਜਾਂ ਵਿੱਚ ਭੰਗੜੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਵਿਆਹ ਸ਼ਾਦੀਆਂ ਵਿਚ ਨੱਚਣ ਸਮੇਂ ਭੰਗੜੇ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਸਕੂਲਾਂ ਕਾਲਜਾਂ ਵਿੱਚ ਭੰਗੜਾ ਦੀ ਟੀਮ ਬਣਾਈ ਜਾਂਦੀ ਆ ਉਹਦੀ ਜਿਹੜੀ ਵੱਖਰੀ ਪੋਸ਼ਾਕ ਹੁੰਦੀ ਹੈ ਜਿਵੇਂ ਕਿ ਗੱਭਰੂਆਂ ਦਾ ਚਾਦਰੇ ਲਾਏ ਜਾਂਦੇ ਹਨ ਗਲ 'ਚ ਕੈਂਠੇ ਹੁੰਦੇ ਹੈ ਅਤੇ ਸਿਰ 'ਤੇ ਪੱ ਦਸਤਾਰ ਵੀ ਹੁੰਦੀ ਹੈਗੀ ਹੈ ਇਹਦੇ ਨਾਲ ਉਹ ਸ ਆਪਣੇ ਦੇਖਣ ਵਿੱਚ ਸੋਹਣੇ ਲੱਗਦੇ ਹਨ ਅਤੇ ਹਰੇਕ ਨੂੰ ਆਪਣੇ ਵੱਲ ਆਕਰਸ਼ਿਤ ਵੀ ਕਰਦੇ ਹਨ ਇਸ ਲਈ ਭੰਗੜਾ ਪੰਜਾਬੀਆਂ ਦਾ ਇੱਕ ਬਹੁਤ ਪ੍ਰਸਿੱਧ ਲੋਕ ਨਾਚ ਹੈ ਇਹਦੇ ਨਾਲ ਪੰਜਾਬੀ ਆਪਣੇ